ਸਤਿ ਸ਼੍ਰੀ ਅਕਾਲ ਵੀਰੇ ਹਾਂ ਵੀਰੇ ਤੁਹਾਡਾ ਨਾ ਨੰਬਰ ਲਿਆ ਸੀ ਕਿਸੇ ਦੋਸਤ ਤੋਂ ਤੁਸੀਂ ਮਾਨਸਾ ਤੋਂ ਬੋਲਦੇ ਵੀਰੇ ਠੀਕ ਹੈ ਵੀਰੇ ਇਹ ਅਸੀਂ ਨਾ ਘੁੰਮਣ ਆਉਣਾ ਸੀ ਇੱਧਰ ਮਾਨਸਾ ਹਾਂ ਅਤੇ ਤੁਸੀਂ ਦੱਸ ਦਉਗੇ ਵੀ ਇੱਧਰ ਕਿਹੜੀਆਂ ਕਿਹੜੀਆਂ ਥਾਂਵਾਂ ਨੇ ਘੁੰਮਣ ਵਾਲੀਆਂ ਅਸੀਂ ਤਾਂ ਵੀਰੇ ਪਟਿਆਲੇ ਤੋਂ ਬੋਲਦੇ

ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਸਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਕਿੰਨਾ ਕੁ ਟੈਮ ਲੱਗ ਜੂਗਾ ਇਹਦਾ ਜੀ ਕਿੰਨਾ ਕੁ ਟਾਇਮ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਅਤੇ ਹੋਰ ਹੋਰ ਕੁਛ ਤਾਂ ਨਹੀਂ ਹੈਗਾ ਘੁੰਮਣ ਨੂੰ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਫਿਰ ਤੁਹਾਨੂੰ ਮੈਂ ਨਾ ਦੋਸਤਾਂ ਨਾਲ ਰਾਏ ਕਰਕੇ ਦਸੂੰਗਾ ਜੀ ਫਿਰ ਅਸੀਂ ਜਦੋਂ ਆਵਾਂਗੇ ਤਾਂ ਤੁਹਾਨੂੰ ਫੋਨ ਜ਼ਰੂਰ ਕਰਾਂਗੇ ਠੀਕ ਹੈ ਜੀ ਠੀਕ ਹੈ ਸਰ ਕੋਈ ਗੱਲ ਨਹੀਂ ਹਾਂ ਠੀਕ ਹੈ ਸਰ ਓਕੇ ਸਰ ਓਕੇ ਬਾਏ ਬਾਏ